ਹੈਲੋ ਹਾਂਜੀ ਹਾਂਜੀ ਮੈਮ ਮੈਂ ਨੀਤੇ ਬੋਲ ਰਹੀ ਹਾਂ ਕੰਨ 'ਚ ਪ੍ਰੌਬਲਮ ਹੈ ਤੁਹਾਨੂੰ ਅੱਛਾ ਅਤੇ ਮਤਲਬ ਮਤਲਬ ਤੁਸੀਂ ਮ ਤੁਸੀਂ ਇੱਥੇ ਆ ਸਕਦੇ ਹੋ ਮੇਰੇ ਕੋਲ ਕਲੀਨਿਕ ਮੇਰੇ ਹਾਂਜੀ ਓਕੇ ਅੱਛਾ ਅਤੇ ਠੀਕ ਹੈ ਮੈਡਮ ਤੁਹਾਨੂੰ ਮਤਲਬ ਪੁੱਛ ਪਹਿਲਾਂ ਘਰ ਦੇ ਨੁਸਖੇ ਦੱਸ ਦਿੰਦੇ ਆ ਹੈ ਨਾ ਅਤੇ ਜਿਵੇਂ ਜਿਵੇਂ ਮਤਲਬ ਉਹਦੇ ਵਿੱਚ ਤੇਲ 'ਚ ਨਾ ਲਸਣ ਨੂੰ ਗਰਮ ਮਤਲਬ ਗਰਮ ਕਰਕੇ ਅਤੇ ਤੁਸੀਂ ਕੰਨ ਵਿੱਚ ਪਾ ਕੇ ਦੇਖਿਓ ਹੈ ਨਾ ਤੁਸੀਂ ਮਤਲਬ ਫਿਲਹਾਲ ਲਈ ਕੰਨ 'ਚ ਪਾ ਕੇ ਦੇਖਿਓ ਸ਼ਾਇਦ ਮੈ ਤੁਹਾਡਾ ਠੀਕ ਹੋ ਜਾਵੇ ਹੈ ਨਾ ਮਤਲਬ ਥੋੜ੍ਹਾ ਬਹੁਤ ਠੀਕ ਹੋਜੂਂਗਾ ਥੋੜ੍ਹਾ ਬਹੁਤ ਆਰਾਮ ਹੋਜੂਂਗਾ ਅਤੇ ਮੈਂ ਬਾਕੀ ਤੁਹਾਨੂੰ ਥੋੜੇ ਬਹੁਤ ਦਵਾਈਆਂ ਮਤਲਬ ਕੀ ਥੋੜ੍ਹਾ ਬਹੁਤ ਤੁਹਾਨੂੰ ਮੈਂ ਵਟਸਐਪ 'ਤੇ ਮਤਲਬ ਮੈਂ ਸੈਂਡ ਏ ਕਰ ਦੂਂਗੀ ਦਵਾਈ ਵਗੈਰਾ ਅਗਰ ਤੁਸੀਂ ਬਾਕੀ ਤੁਸੀਂ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਮੈਂ ਵੈਸੇ ਫਰੀ ਕੱਲ ਹਾਂ ਜੇ ਤੁਸੀਂ ਕੱਲ ਆ ਸਕਦੇ ਹੋ ਤਾਂ ਵੇਖ ਸਕ ਦੇਖ ਲਓ ਮੈਂ ਫਰੀ ਹਾਂ ਸਾਢੇ ਗਿਆਰਾਂ ਵਜੇ ਤੱਕ ਹਾਂਜੀ ਜੇ ਮਤਲਬ ਜਿੱਦਾਂ ਹੁਣ ਤੁਸੀਂ ਐਕਸਰਾਅ ਵਗੈਰਾ ਕਰਾ ਕੇ ਵੇਖ ਲਿਓ ਹਨਾ ਕੰਨ ਤੱਕ ਵੀ ਕਈ ਵਾਰੀ ਪ੍ਰੋਬਲਮ ਜ਼ਿਆਦਾ ਵੀ ਹੁੰਦੇ ਆ ਨਾ ਹਾਂਜੀ ਹਾਂਜੀ ਠੀਕ ਹੈ ਜੀ ਕੱਲ ਤੁਸੀਂ ਆ ਜਿਓ ਫਿਰ ਮੈਂ ਦੇਖ ਕੇ ਤੁਹਾਨੂੰ ਦੱਸ ਦਵਾਂਗੀ ਥੈਂ ਓਕੇ ਵੈਲਕਮ